ਸਤਾਈ ਮਾਰਚ ਦੋ ਹਜ਼ਾਰ ਚੌਵੀ ਬਾਰ੍ਹਾਂ ਅਪ੍ਰੈਲ ਦੋ ਹਜ਼ਾਰ ਪੰਜ ਬਾਰ੍ਹਾਂ ਦਸੰਬਰ ਦੋ ਹਜ਼ਾਰ ਦੋ ਪੱਚੀ ਅਗਸਤ ਉੱਨੀ ਸੌ ਛਿਹੱਤਰ ਉਨੱਤੀ ਸਤੰਬਰ ਉੱਨੀ ਸੌ ਬਹੱਤਰ